ਜੀ ਹਾਂ ਕਈ ਵਾਰੀ ਬੰਦੇ ਦੇ ਮੂੜ 'ਤੇ ਡਿਪੈਂਡ ਕਰਦਾ ਹੈ ਕਿ ਉਹ ਕੀ ਬਣਾਉਣਾ ਚਾਹੁੰਦਾ ਹੈ ਕੀ ਢਾਹੁਣਾ ਚਾਹੁੰਦਾ ਹੈ ਕੀ ਉਸਾਰਨਾ ਚਾਹੁੰਦਾ ਹੈ ਬਣਾਉਣ ਦੀ ਪ੍ਰੇਰਨਾ ਹਮੇਸ਼ਾ ਆਪਣੇ ਮਾਪਿਆਂ ਤੋਂ ਹੀ ਮਿਲਦੀ ਛੋਟੇ ਹੁੰਦੇ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਕਾਗਜ਼ ਦੇ ਉੱਤੇ ਕੋਰੀਆਂ ਲਕੀਰਾਂ ਫੇਰਦਾ ਹੈ ਅਤੇ ਕਈ ਵਾਰੀ ਲਕੀਰਾਂ ਇੱਕ ਚਿੱਤਰ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਜਿਸ ਤੋਂ ਬੰਦੇ ਦੀ ਹੋਬੀਜ਼ ਦਾ ਪਤਾ ਲੱਗਦਾ ਹੈ ਕਿ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਰੋਜ਼ਾਨਾ ਨਿੱਤ ਕੰਮਾਂ ਵਿੱਚ ਚਿੱਤਰਕਾਰੀ ਦਾ ਬਹੁਤ ਸੁਮੇਲ ਹੈ ਕਿਉਂਕਿ ਬੰਦੇ ਦੀ ਇੱਕ ਕਾਲਪਨਿਕ ਖੋਜ ਹੁੰਦੀ ਹੈ ਕਿ ਉਹ ਕੀ ਬਣਾ ਰਿਹਾ ਕਿ ਢਾਹ ਰਿਹਾ ਉਸ ਦੀ ਸੋਚ 'ਤੇ ਨਿਰਭਰ ਕਰਦਾ ਜਦੋਂ ਵੀ ਉਹ ਕੋਈ ਕਾਗਜ਼ ਪੈੱਨ ਲੈ ਕੇ ਕਲਪਨਾ ਕਰਦਾ ਹੈ ਕੁਝ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਵਿੱਚੋਂ ਬਹੁਤ ਹੀ ਸਿੱਖਿਆਦਾਇਕ ਪ੍ਰੇਰਨਾ ਮਿਲਦੀ ਹੈ ਜਿਵੇਂ ਕਿਸੇ ਫੁੱਲ ਦਾ ਚਿੱਤਰ ਬਣਾਉਣ ਵੇਲੇ ਬੰਦੇ ਦੇ ਮਨ ਵਿੱਚ ਉਸ ਫੁੱਲ ਬਾਰੇ ਉਸ ਦੀ ਖੁਸ਼ਬੂ ਬਾਰੇ ਅਤੇ ਉਸ ਦੇ ਬਗੀਚੇ ਬਾਰੇ ਉਸ ਦੇ ਮਾਲੀ ਬਾਰੇ ਕਈ ਪ੍ਰਕਾਰ ਦੀਆਂ ਕਲਪਨਾ ਦਿਮਾਗ ਵਿੱਚ ਆਉਂਦੀਆਂ ਹਨ ਬੰਦਾ ਹਮੇਸ਼ਾ ਕੁਛ ਨਾ ਕੁਛ ਚਿਤਰਨ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਸੈਰ ਕਰਦਾ ਹੋਇਆ ਫੁੱਲ ਬੂਟਿਆਂ ਨੂੰ ਦੇਖ ਰਿਹਾ ਚਿੱਤਰਕਾਰੀ ਕਰਦਾ ਹੈ ਇਸ ਦਾ ਵਾਲਪੇਪਰ ਕਿਵੇਂ ਬਣਨਾ ਹੈ ਇਸ ਨੂੰ ਕਿਵੇਂ ਅੱਗੇ ਤੋਰਨਾ ਹੈ ਤਾਂ ਇਸ ਤਰ੍ਹਾਂ ਦੇ ਖਿਆਲ ਜਦੋਂ ਆਉਂਦੇ ਹਨ ਤਾਂ ਉਹ ਇੱਕ ਚਿੱਤਰ ਦਾ ਰੂਪ ਧਾਰਨ ਕਰ ਲੈਂਦਾ ਇਸ ਦਾ ਕਾਰਨ ਇਹ ਹੈ ਕਿ ਬਣਾਉਣ ਦੀ ਜਿਹੜੀ ਕਲਪਨਾ ਹੈ ਬਣਾਉਣ ਦੀ ਜਿਹੜੀ ਪ੍ਰੇਰਣਾ ਹੈ ਉਹ ਆਪਣੇ ਦਿਮਾਗ ਦੀ ਉਪਜ ਹੈ ਵੱਡੇ ਵੱਡੇ ਚਿੱਤਰਕਾਰ ਗੋਸੋ ਵਰਗੇ ਚਿੱਤਰਕਾਰ ਜਿਹੜੇ ਆਪਣੀ ਕਲਪਨਾ ਦੇ ਨਾਲ ਇਹੋ ਜਿਹੀ ਚਿਤਰਕਾਰੀ ਕਰਦੇ ਸੀ ਕਿ ਉਹਨਾਂ ਚਿੱਤਰਾਂ ਦਾ ਮੁੱਲ ਬਹੁਤ ਹੀ ਜ਼ਿਆਦਾ ਪੈ ਜਾਂਦਾ ਸੀ ਅੱਜ ਕੱਲ੍ਹ ਇਹੋ ਜਿਹੇ ਚਿੱਤਰਕਾਰ ਵੀ ਹਨ ਜਿਹਨਾਂ ਦੀਆਂ ਬਣਾਈਆਂ ਹੋਈਆਂ ਪੇਂਟਿੰਗ ਬਣਾਈਆਂ ਹੋਈਆਂ ਚਿੱਤਰਕਾਰੀਆਂ ਲੱਖਾਂ ਡਾਲਰਾਂ ਦੇ ਵਿੱਚ ਵਿਕਦੀਆਂ ਹਨ ਅਤੇ ਉਹਨਾਂ ਦੀਆਂ ਪ੍ਰਦਰਸ਼ਨੀਆਂ ਵੀ ਲੱਗਦੀਆਂ ਹਨ ਸੋ ਹਰ ਬੰਦਾ ਇਹੀ ਚਾਹੁੰਦਾ ਹੈ ਕਿ ਮੇਰੇ ਜਿਹੜੇ ਚਿੱਤਰ ਨੇ ਜਾਂ ਮੇਰੇ ਜਿਹੜੇ ਲਕੀਰੇ ਹੋਏ ਕਾਗਜ਼ ਉੱਤੇ ਉਕਰੀਆਂ ਹੋਈਆਂ ਲਕੀਰਾਂ ਦਾ ਮੁੱਲ ਪਵੇ ਅਤੇ ਮੈਂ ਵੀ ਆਪਣੇ ਆਪ ਨੂੰ ਉਸ ਸ਼੍ਰੇਣੀ ਦੇ ਵਿੱਚ ਸ਼ਾਮਿਲ ਕਰ ਸਕਾਂ ਜਿੱਥੋਂ ਲੋਕ ਬਹੁਤ ਜ਼ਿਆਦਾ ਕਮਾਈ ਕਰਦੇ ਹਨ ਜਾਂ ਮਸ਼ਹੂਰ ਹੋਣਾ ਚਾਹੁੰਦੇ ਹਨ ਧੰਨਵਾਦ ਜੀ